ਸਤਿ ਸ਼੍ਰੀ ਅਕਾਲ ਮੇਰੇ ਦੁਆਰਾ ਸਭ ਤੋਂ ਜ਼ਿਆਦਾ ਵਰਤੇ ਗਏ ਐਪਸ ਹੈਗੇ ਆ ਯੂਟਿਊਬ ਇੰਸਟਾਗ੍ਰਾਮ ਵੋਟਸਐਪ ਅਤੇ ਫ਼ੋਨ ਡਾਇਲ ਐਪ ਫ਼ੋਨ ਡਾਇਲ ਐਪ 'ਤੇ ਇਸ ਲਈਏ ਕਿ ਤਾਂ ਕਿ ਮੈਂ ਆਪਣੇ ਮੰਮੀ ਪਾਪਾ ਨੂੰ ਜਾਂ ਦੋਸਤ ਨੂੰ ਜਾਂ ਕੰਮ ਵਿੱਚ ਕਿਸੇ ਨੂੰ ਵੀ ਕੌਲ ਕਰ ਸਕਾਂ ਇੰਸਟਾਗ੍ਰਾਮ 'ਤੇ ਕਈ ਤਰੀਕੇ ਦੀ ਤਸਵੀਰਾਂ ਅਤੇ ਵੀਡੀਓ ਆਉਂਦੀ ਹੈ ਜੋ ਉਹ ਸਾਨੂੰ ਦੇਸ਼ 'ਚ ਕੀ ਹੋ ਰਿਹਾ ਹੈ ਜਾਂ ਫਿਰ ਮਨੋਰੰਜਨ ਲਈ ਜਾਂ ਫਿਰ ਸਾਡਾ ਕੋਈ ਵੀ ਦੋਸਤ ਜਾਂ ਰਿਸ਼ਤੇਦਾਰ ਕਿਸੇ ਦੁਨੀਆਂ ਦੇ ਕੋਨੇ ਵਿੱਚ ਕੀ ਕਰਦਾ ਪਿਆ ਏ ਉਹਨੂੰ ਜਾਣਨ ਲਈ ਇਸਤੇਮਾਲ ਕਰਦੇ ਹਾਂ ਦੂਜਾ ਯੂਟਿਊਬ ਕਦੇ ਵੀ ਕੋਈ ਪੜ੍ਹਾਈ ਤੋਂ ਜਾਂ ਸ ਕੋਲੇਜ ਤੋਂ ਜਾਂ ਸਕੂਲ ਤੋਂ ਕੁਛ ਵੀ ਸਿੱਖਣ ਲਈ ਕਿਹਾ ਜਾਂਦਾ ਹੈ ਤਾਂ ਅਸੀਂ ਯੂਟਿਊਬ ਨੂੰ ਖੋਲ੍ਹ ਕੇ ਉਸ 'ਤੇ ਲਿਖ ਦਿੰਦੇ ਹਾਂ ਜੋ ਵੀ ਸਾਨੂੰ ਜਾਣਨਾ ਹੁੰਦਾ ਜਾਂ ਕੋਈ ਵੀ ਚੀਜ਼ ਜਾਣਨੀ ਹੁੰਦੀ ਆ ਅਤੇ ਉਸ ਤੋਂ ਸਾਨੂੰ ਜਾਣਕਾਰੀ ਮਿਲਦੀ ਹੈਗੀ ਆ ਵੋਟਸਐਪ 'ਤੇ ਕੋਈ ਵੀ ਰਿਸ਼ਤੇਦਾਰ ਦੇ ਬਾਰੇ ਜਾਣਨਾ ਹੋ ਜਾਂ ਮੰਮੀ ਪਾਪਾ ਦੇ ਬਾਰੇ ਜਾਣਨਾ ਹੋ ਕਿ ਉਹ ਕੀ ਕਰਦੇ ਪਏ ਆ ਕਿਤੇ ਹੈਗੇ ਆ ਜਾਂ ਫਿਰ ਵੀਡੀਓ ਕੌਲ ਕਰਨ ਲਈ ਅਸੀਂ ਇਸਤੇਮਾਲ ਕਰਦੇ ਹੈਗੇ ਹਾਂ ਅਤੇ ਨੈੱਟਫਲਿਕਸ 'ਤੇ ਕੋਈ ਵੀ ਨਈ ਮੂਵੀ ਜਾਂ ਚਿੱਤਰਕਾਰੀ ਮੂਵੀ ਆਉਂਦੀ ਹੁੰਦੀ ਹੈ ਤਾਂ ਉਹਨੂੰ ਦੇਖਣ ਲਈ ਇਸਤੇਮਾਲ ਕਰਦੇ ਹੈ ਜ਼ਿਆਦਾਤਰ ਲੋਕ ਇਹਨੂੰ ਆਪਣੇ ਮਨੋਰੰਜਨ ਲਈ ਇਸਤੇਮਾਲ ਕਰਦੇ ਆ